ਹੈਲੋ ਸਤਿ ਸ਼੍ਰੀ ਆਕਾਲ ਭਾਅ ਜੀ ਕੀ ਹਾਲ ਚਾਲ ਨੇ ਸੁਰਿੰਦਰ ਬੋਲ ਰਿਹਾ ਭਾਅ ਜੀ ਮੈਂ ਹਾਂ ਮੈਨੂੰ ਇੱਕ 'ਚ ਕੰਮ ਪੈ ਗਿਆ ਸੀ ਤੁਹਾਡੇ ਨਾਲ ਉਹ ਘਰ ਬਗੀਚਾ ਬਣਾਇਆ ਵਾ ਜੀ ਇੱਕ ਫੁੱਲਾਂ ਦਾ ਕੋਈ ਪੌਦਿਆਂ ਦਾ ਅਤੇ ਉਹ ਤਾਂ ਥੋੜ੍ਹਾ ਸਫਾਈ ਵੀ ਕਰਵਾਉਣੀ ਅਤੇ ਪੌਦੇ ਹੋਰ ਵੀ ਲਾਉਣੇ ਸੀ ਪਾਰਕਿੰਗ 'ਚ ਪਾਰਕਿੰਗ 'ਚ ਪਾਰਕਿੰਗ ਤਿਆਰ ਕਰਨੀ ਹੈ ਜੀ ਪੂਰੀ ਹਾਂਜੀ ਹਾਂਜੀ ਅਤੇ ਕਦੋਂ ਕੁ ਤਿਕਰ ਤੁਸੀਂ ਬਾਲਕਨੀ ਤਿਆਰ ਕਰਨੀ ਆ ਜੀ ਅਤੇ ਕਿਸੇ ਦਿਨ ਤੁਸੀਂ ਟਾਈਮ ਕੱਢੋਗੇ ਆਓਗੇ ਕਿਸ ਦਿਨ ਟਾਈਮ ਕੱਢੋਗੇ ਆਓਗੇ ਤੁਸੀਂ ਬਾਲਕਨੀ ਤਿਆਰ ਕਰਨੀ ਹਾਂਜੀ ਐਤਵਾਰ ਆ ਜਾਓਗੇ ਐਤਵਾਰ ਮੈਨੂੰ ਛੁੱਟੀ ਹੁੰਦੀ ਹੈ ਆਜੋਗੇ ਚਲੋ ਐਤਵਾਰ ਆ ਜਿਓ ਫਿਰ ਚਲੋ ਕੋਈ ਗੱਲ ਨਹੀਂ ਆ ਜਿਓ ਫਿਰ ਕਰ ਜਿਓ ਫਿਰ ਜੋ ਵੀ ਤੁਹਾਡੀ ਸੇਵਾ ਹੈਗੀ ਤੁਹਾਡੀ ਸੇਵਾ ਕਰ ਦਿਆਂਗੇ ਠੀਕ ਹੈ ਜੀ ਠੀਕ ਹੈ ਠੀਕ ਹੈ